ਮੈਨੂੰ ਸਿੱਖ ਧਰਮ ਬਹੁਤ ਆਕਰਸ਼ਿਤ ਕਰਦਾ ਹੈ ਉਸਦਾ ਕਾਰਨ ਇਹ ਹੈ ਇਸ ਦੀ ਬਾਣੀ ਜੋ ਕਹਿੰਦੀ ਹੈ ਕਿ ਜਿਵੇਂ ਰੱਬ ਨੇ ਤੁਹਾਨੂੰ ਪੈਦਾ ਕੀਤਾ ਭੇਜਿਆ ਉੱਦਾਂ ਹੀ ਰਹੋ ਕੋਈ ਵੀ ਰੋਮ ਨਾ ਆਪਣਾ ਕੱਟੋ ਸਿੱਖਧਾਰੀ ਬੱਚੇ ਬਣੋ ਲੰਗਰ ਛਕੋ ਛਕਾਓ ਕਿਰਤ ਕਰੋ ਵੰਡ ਛਕਣ ਦੀ ਇਹ ਕਿਰਤ ਵੰਡ ਛਕਣ ਲਈ ਇਹ ਕਹਿੰਦੇ ਨੇ ਅਸੀਂ ਦੁਨੀਆ 'ਤੇ ਆਏ ਹਾਂ ਦੂਜਿਆਂ ਲਈ ਥੋੜ੍ਹਾ ਜਿਹਾ ਰਸਤਾ ਅਸਾਨ ਕਰ ਸਕਦੇ ਹਾਂ ਉਹਨਾਂ ਦਾ ਇਹ ਕੰਮ ਕਰਨ ਨੂੰ ਵੀ ਕਹਿੰਦਾ ਹੈ ਇਹ ਨਹੀਂ ਕਹਿੰਦਾ ਕਿ ਸਾਰੀ ਜ਼ਿੰਦਗੀ ਸਾਰੀ ਦਿਹਾੜੀ ਆਪਣੀ ਸਾਰਾ ਦਿਨ ਜੋ ਹੈ ਉਹ ਗੁਰਦੁਆਰਿਆਂ ਵਿੱਚ ਬਿਤਾਓ ਤੁਸੀਂ ਆਪਣੀ ਕਿਰਤ ਕਮਾਈ ਕਰੋ ਇਹਨਾਂ ਦਾ ਬਹੁਤ ਹੀ ਸੋਹਣਾ ਜੋ ਤਿਉਹਾਰ ਹੁੰਦੇ ਹਨ ਉਹ ਹੈ ਦਿਵਾਲੀ ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਬਵੰਜਾ ਰਾਜਿਆਂ ਦੇ ਨਾਲ ਕਿਲ੍ਹੇ 'ਚੋਂ ਆਜ਼ਾਦ ਹੋਏ ਸੀ ਮੈਂ ਹਰਿਮੰਦਰ ਸਾਹਿਬ ਜਾਂਦਾ ਹਾਂ ਜਦੋਂ ਉੱਥੇ ਆਤਿਸ਼ਬਾਜੀ ਹੁੰਦੀ ਹੈ ਬਹੁਤ ਸੋਹਣੀ ਲੱਗਦੀ ਹੈ ਲੰਗਰ ਪ੍ਰਸ਼ਾਦਾ ਛਕੀ ਦਾ ਹੈ ਵਾਪਸ ਆਈ ਦਾ ਘਰ ਆਪਣੇ ਪੂਜਾ ਕਰਕੇ ਫਿਰ ਆਪਣੀ ਜੋ ਦਿਵਾਲੀ ਹੈ ਉਹ ਮਨਾਈ ਦੀ ਹੈ ਜੋ ਕਿ ਬਹੁਤ ਹੀ ਵਧੀਆ ਲੱਗਦਾ ਹੈ